ਮੇਰੇ ਕੋਲ ਕਾ ਕਾਲਜ ਪਾਉਣ ਲਈ ਕੱਪੜੇ ਨਹੀਂ ਰਹੇ ਇਸ ਲਈ ਮੈਂ ਬਜ਼ਾਰ ਜਾਣ ਬਾਰੇ ਸੋਚਿਆ ਫਿਰ ਜਦੋਂ ਮੈਂ ਬਜ਼ਾਰ ਗਈ ਅਤੇ ਉੱਥੇ ਮੈਨੂੰ ਕੋਈ ਵੀ ਵਧੀਆ ਕਪੜੇ ਨਹੀਂ ਮਿਲੇ ਇਸ ਕਰਕੇ ਮੈਂ ਬਹੁਤ ਜ਼ਿਆਦਾ ਕੱਪੜੇ ਦੇਖੇ ਫਿਰ ਮੈਨੂੰ ਕੋਈ ਵੀ ਵਧੀਆ ਕਪੜੇ ਨਹੀਂ ਮਿਲੇ ਇਸ ਕਰਕੇ ਮੈਂ ਔਨਲਾਇਨ ਆਡਰ ਕਰਨ ਬਾਰੇ ਸੋਚਿਆ ਅਤੇ ਔਨਲਾਇਨ ਮੈਂ ਦੋ ਤੋਂ ਤਿੰਨ ਕਪ ਸੂਟ ਆਡਰ ਕੀਤੇ ਸੀ ਪਹਿਲਾਂ ਮੈਂ ਕੱਪੜੇ ਦੇਖੇ ਔਨਲਾਇਨ ਫਿਰ ਉਹ ਮੈਨੂੰ ਮ ਮਤਲਬ ਪਹਿਲਾਂ ਮੈਨੂੰ ਇਹ ਵੀ ਲੱਗਿਆ ਸੀ ਕਿ ਹੈ ਨਾ ਕਿ ਇਹ ਖਰਾਬ ਨਾ ਨਿਕਲਣ ਫਿਰ ਮੈਂ ਔਨਲਾਇਨ ਕੱਪੜੇ ਮੰਗਵਾਏ ਔਨਲਾਇਨ ਕੱਪੜੇ ਜਿਹੜੇ ਵੀ ਮੈਂ ਮੰਗਵਾਏ ਪਹਿਲਾਂ ਉਨ੍ਹਾਂ ਦੀ ਡਿਲੀਵਰੀ ਬਹੁਤ ਜ਼ਿਆਦਾ ਲੇਟ ਹੋਈ ਡਿਲੀਵਰੀ ਵਾਲਿਆਂ ਨੇ ਪਹਿਲਾਂ ਗਲਤ ਐੱਡਰਸ 'ਤੇ ਭੇਜ ਤੇ ਉਹ ਫਿਰ ਮੈਂ ਉਨ੍ਹਾਂ ਨਾਲ ਸੰਪਰਕ ਕਰਕੇ ਅਪ ਆਪਣੇ ਐੱਡਰਸ 'ਤੇ ਮੰਗਵਾਏ ਫਿਰ ਜਦੋਂ ਉਹ ਉਹਨਾਂ ਨੇ ਮੈਨੂੰ ਮੇਰੇ ਐੱਡਰਸ 'ਤੇ ਭੇਜੇ ਕੱਪੜੇ ਤਾਂ ਉਨ੍ਹਾਂ ਦਾ ਕੱਪੜਾ ਬਿਲਕੁਲ ਵੀ ਅੱਛਾ ਨਹੀਂ ਸੀ ਉਹਨਾਂ ਦਾ ਡਿਜ਼ਾਇਨ ਵੀ ਬਹੁਤ ਜ਼ਿਆਦਾ ਹੀ ਬੇਕਾਰ ਸੀ ਜੋ ਡਿਜ਼ਾਇਨ ਦਿਖਾਇਆ ਗਿਆ ਸੀ ਉਹ ਵਾਲਾ ਡਿਜ਼ਾਇਨ ਉਸ ਕੁੜਤਿਆਂ 'ਤੇ ਨਹੀਂ ਸੀ ਅਤੇ ਉਹਨਾਂ ਦੀ ਕਢਾਈ ਵੀ ਅੱਛੀ ਨਹੀਂ ਸੀ ਉਨ੍ਹਾਂ ਦਾ ਪਰਾਇਜ਼ ਵੀ ਬਹੁਤਾ ਸਹੀ ਨਹੀਂ ਸੀ ਉਹਨਾਂ ਦਾ ਕਲਰ ਵੀ ਬਹੁਤ ਅੱਛਾ ਨਹੀਂ ਸੀ ਅਤੇ ਜਦੋਂ ਵੀ ਮੈਂ ਪਹਿਲੀ ਵਾਰੀ ਪਾ ਕੇ ਉਨ੍ਹਾਂ ਨੂੰ ਧੋਇਆ ਤਾਂ ਉਨ੍ਹਾਂ ਦਾ ਸਾਰਾ ਰੰਗ ਉੱਡ ਗਿਆ ਉਹਨਾਂ ਦੀ ਕਢਾਈ ਜੋ ਹੈ ਉਹ ਵੀ ਖਰਾਬ ਹੋ ਗਈ ਉਨ੍ਹਾਂ ਦੀ ਫੀਟਿੰਗ ਜੋ ਹੈ ਉਹ ਵੀ ਅੱਛੀ ਨਹੀਂ ਸੀ ਅਤੇ ਇੱਕ ਵਾਰੀ ਧੋਣ ਤੋਂ ਬਾਅਦ ਹੀ ਉਹ ਛਿੱਜ ਗਏ ਉਹਨਾਂ ਮਤਲਬ ਇਹ ਓਵਰਆਲ ਉਹ ਐਕਸਪੀਰੀਅੰਸ ਜੋ ਹੈ ਉਹ ਮੇਰਾ ਵਧੀਆ ਨਹੀਂ ਰਿਹਾ ਔਨਲਾਇਨ ਸ਼ੌਪਿੰਗ ਕਰਨ ਦੇ ਨਾਲ ਜ ਜੋ ਵੀ ਮੈਂ ਮੰਗਵਾਇਆ ਸੀ ਉਹਦੇ ਨਾਲ ਤਕਰੀਬਨ ਮੇਰੇ ਪੈਸੇ ਹੀ ਬਰਬਾਦ ਹੋਏ ਕਿਉਂਕਿ ਮ ਕੋਈ ਜੋ ਜਿਹੜੇ ਵੀ ਮੈਂ ਕੁੜਤੇ ਮੰਗਵਾਏ ਸੀ ਉਹਦਾ ਉਨ੍ਹਾਂ ਨੂੰ ਨੂੰ ਲੈ ਕੇ ਮੈਨੂੰ ਕੋਈ ਵੀ ਸੰਤੁਸ਼ਟੀ ਨਹੀਂ ਹੋਈ